ਕੁਝ ਸਥਾਨਕ ਰਿਹਾਇਸ਼ਾਂ ਵਿਕਲਪ ਜਿਵੇਂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕਿਰਾਇਆ ਹੁੰਦਾ ਹੈ ਜਿਵੇਂ ਵੀਹ ਪੱਚੀ ਤੋਂ ਹਜ਼ਾਰ ਆਪਾਂ ਘੱਟ ਆਪਾਂ ਨੂੰ ਕੋਈ ਕਮਰਾ ਤੱਕ ਵੀ ਨਹੀਂ ਮਿਲਦਾ ਉਸ ਜ਼ਿਆਦਾ ਕਿਰਾਇਆ ਹੁੰਦਾ ਉੱਥੇ ਅਤੇ ਉਸ ਤੋਂ ਬਾਅਦ ਜਿਵੇਂ ਮਾਰਕਿਟ ਹੋ ਗਈ ਮਾਰਕਿਟ ਦੇ ਵਿੱਚ ਸਾਨੂੰ ਪਾਰਕਿੰਗ ਬਾਰੇ ਪਾਰਕਿੰਗ ਵਧੀਆ ਮਿਲਣੀ ਚਾਹੀਦੀ ਹੈ ਕਈ ਵਾਰੀ ਸਾਨੂੰ ਪਾਰਕਿੰਗ ਵੀ ਨਹੀਂ ਮਿਲਦੀ ਸਾਨੂੰ ਰੌੜਾਂ 'ਤੇ ਜਿਹੜੀਆਂ ਆਪਣੀਆਂ ਗੱਡੀਆਂ ਉਹ ਖੜ੍ਹੀਆਂ ਕਰਨੀਆਂ ਪੈਂਦੀਆਂ ਨੇ ਅਤੇ ਜਿਵੇਂ ਪੁਲਿਸ ਵਗੈਰਾ ਵਾਲੇ ਹੁੰਦੇ ਹੈ ਉਹ ਕਈ ਵਾਰ ਟੋਅ ਕਰਕੇ ਲੈ ਜਾਂਦੇ ਨੇ ਗੱਡੀਆਂ ਨੂੰ ਅਤੇ ਉਸ ਤੋਂ ਬਾਅਦ ਜਿਵੇਂ ਛੋਟੇ ਘਰਾਂ ਦਾ ਕਿਰਾਇਆ ਹੈ ਜਿਹੜਾ ਉਹ ਘੱਟ ਹੋਣਾ ਚਾਹੀਦਾ ਹੈ ਕਿਉਂਕਿ ਛੋਟੇ ਘਰਾਂ ਦਾ ਕਿਰਾਇਆ ਵੀ ਸਭ ਤੋਂ ਵੱਧ ਹੈ ਅਤੇ ਉਸ ਤੋਂ ਬਾਅਦ ਜਿਹੜਾ ਸਿੱਖਿਆ ਸਿੱਖਿਆ ਦਾ ਪੱਧਰ ਵੀ ਵਧੀਆ ਹੋਣਾ ਚਾਹੀਦਾ ਜਿੱਦਾਂ ਸਕੂਲ ਕਾਲਜ ਜਿਹੜੇ ਨੇੜੇ ਹੋਣੇ ਚਾਹੀਦੇ ਨੇ ਸਕੂਲ ਰਿਹਾਇਸ਼ੀ ਘਰਾਂ ਤੋਂ ਅਤੇ ਉਸ ਤੋਂ ਬਾਅਦ ਗਰਾਊਂਡ ਵਗੈਰਾ ਜਿਹੜੇ ਬੱਚਿਆਂ ਨੂੰ ਖੇਡਣ ਲਈ ਹੋਣੇ ਚਾਹੀਦੇ ਨੇ